ਮੇਰਾ ਪਹਿਲਾਂ ਡਰਾਇੰਗ ਅਨੁਭਵ ਉਦੋਂ ਹੋਇਆ ਜਦੋਂ ਮੈਂ ਬਹੁਤ ਛੋਟਾ ਸੀ ਅਤੇ ਮੈਨੂੰ ਅਜੇ ਵੀ ਯਾਦ ਹੈ ਉਦੋਂ ਮੈਨੂੰ ਜੋ ਉਤਸਾਹ ਅਤੇ ਖੁਸ਼ੀ ਮਹਿਸੂਸ ਹੋਈ ਸੀ ਮੈਂ ਇੱਕ ਕਾਰਟੂਨ ਤੋਂ ਬਹੁਤ ਪ੍ਰੇਰਿਤ ਸੀ ਜਿਸ ਨੂੰ ਦੇਖਣਾ ਮੈਨੂੰ ਬਹੁਤ ਪਸੰਦ ਸੀ ਅਤੇ ਮੈਨੂੰ ਯਾਦ ਹੈ ਕਿ ਮੈਂ ਸ਼ੋਅ ਦੇ ਕਿਰਦਾਰਾਂ ਨੂੰ ਸਕੈਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾਂ ਇਹ ਸਿਰਫ਼ ਮੌਜ ਮਸਤੀ ਕਰਨ ਅਤੇ ਇਹ ਦੇਖਣ ਬਾਰੇ ਕਿ ਮੈਂ ਕੀ ਬਣਾ ਸਕਦਾ ਹਾਂ ਇਸ ਬਾਰੇ ਬਹੁਤ ਜ਼ਿਆਦਾ ਚਿੰਤਾ ਨਾ ਕਰਦੇ ਹੋਏ ਕੀ ਇਹ ਕਿਵੇਂ ਨਿਕਲਿਆ ਮੈਂ ਸਿਰਫ਼ ਸਕਰੀਨ 'ਤੇ ਦੇਖੇ ਗਏ ਚਿੱਤਰਾਂ ਨੂੰ ਕਾਗਜ਼ 'ਤੇ ਤਬਦੀਲ ਕਰਨ ਦੀ ਪ੍ਰਕਿਰਿਆ ਦਾ ਆਨੰਦ ਮਾਣ ਰਿਹਾ ਸੀ ਪਰ ਜਿਵੇਂ ਜਿਵੇਂ ਮੈਂ ਆਜ਼ਿਦਾ ਤੋਂ ਜ਼ਿਆਦਾ ਅਭਿਆਸ ਕੀਤਾ ਕੁਝ ਦਿਲਚਸਪ ਚੀਜ਼ ਹੋਈ ਜਿੰਨਾ ਜਿਨ ਜ਼ਿਆਦਾ ਮੈਂ ਖਿੱਚਿਆ ਉੰਨਾਂ ਹੀ ਮੈਂ ਇਸ ਦਾ ਆਨੰਦ ਲੈਣ ਲੱਗ ਪਿਆ ਸਿਰਫ਼ ਇੱਕ ਪੈਨਸਲ ਅਤੇ ਸਕੈਚ ਅਤੇ ਕੁਝ ਕਾਗਜ਼ਾਂ ਨਾਲ ਕਿਸੇ ਚੀਜ਼ ਨੂੰ ਜੀਵਨ ਵਿੱਚ ਲਿਆਉਣ ਵਿੱਚ ਸੰਤੁਸ਼ਟੀ ਦੀ ਭਾਵਨਾ ਸੀ ਜਿਵੇਂ ਜਿਵੇਂ ਮੈਂ ਆਪਣੇ ਹੁਨਰ ਨੂੰ ਨਿਖਾਰਦਾ ਰਿਹਾ ਉਵੇਂ ਉਵੇਂ ਹੀ ਮੈਨੂੰ ਡਰਾਇੰਗ ਕਰਨ ਵਿੱਚ ਮਜ਼ਾਂ ਆਉਣ ਲੱਗ ਪਿਆ ਇਸ ਤਰ੍ਹਾਂ ਆਹਾ ਮੇਰਾ ਸ਼ੌਂਕ ਬਣ ਗਿਆ